ਹੈਲੋ ਨਮਸਤੇ ਸਰ ਨਮਸ਼ਕਾਰ ਜੀ ਨਮਸ਼ਕਾਰ ਸਰ ਆਪਾਂ ਫੋਟੋਆਂ ਖਿਚਵਾਉਣੀਆਂ ਸੀ ਜੀ ਆਪਣੇ ਨਾ ਸਿਸਟਰ ਦੀ ਮੈਰਿਜ ਹੈਗੀ ਜੀ ਦਸ ਤਾਰੀਖ ਨੂੰ ਦਸ ਤਾਰੀਖ ਨੂੰ ਇਸ ਮੰਥ ਦੀ ਮਤਲਬ ਨੈਸਟ ਮੰਥ ਆ ਰਿਹਾ ਜਿਹੜਾ ਇਹ ਤਾਂ ਕਰਕੇ ਫੋਟੋ ਖਿਚਵਾਉਣੀ ਸੀ ਜੀ ਸਰ ਕੀ ਪ੍ਰਾਈਸ ਚੱਲੀ ਜਾਂਦਾ ਫੋਟੋਆਂ ਦਾ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਉੱਦੋਂ ਵੱਡੀ ਥੋੜ੍ਹੀ ਜਿਹੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਓਦਾ ਕੀ ਅੱਛਾ ਜੀ ਛੇ ਅੱਠ ਠੀਕ ਹੈ ਜੀ ਹਾਂਜੀ ਛੇ ਅੱਠ ਦਾ ਕਿੰਨਾ ਕੋਸਟ ਪੈਂਦਾ ਜੀ ਆਪਾਂ ਨੂੰ ਠੀਕ ਹੈ ਜੀ ਸਰ ਐਂ ਨਾ ਵੀ ਇੰਗੇਜਮੈਂਟ ਹੈਗੀ ਸਿਸਟਰ ਦੀ ਤਾਂ ਕਰਕੇ ਨਾ ਪਹਿਲਾਂ ਉਹ ਦੂਜੀਆਂ ਵੀ ਆਪਾਂ ਕਰਵਾਉਣੀ ਜਿਹੜਾ ਪ੍ਰੋਗਰਾਮ ਉਹ ਵੀ ਕਰਵਾਉਣੀਆਂ ਅਤੇ ਉੱਦੋਂ ਬਾਅਦ ਫਿਰ ਮੈਰਿਜ ਦੀ ਹੋ ਗਈ ਤਾਂ ਕਰਕੇ ਵੀ ਥੋੜ੍ਹਾ ਜਿਹਾ ਬਜਟ ਵੀ ਧਿਆਨ 'ਚ ਰੱਖਣਾ ਆਪਾਂ ਅਤੇ ਫਿਰ ਦਸ ਬਾਰਾਂ ਦੀ ਸਹੀ ਆ ਮੇਰੇ ਹਿਸਾਬ ਨਾਲ ਹਾਂਜੀ ਜੀ ਆਹ ਸਹੀ ਹੈ ਫਿਰ ਥੋੜ੍ਹਾ ਜਿਹਾ ਨਾ ਵੱਡਾ ਵੀ ਹੋਣਾ ਚਾਹੀਦਾ ਫੋਟੋ ਥੋੜ੍ਹੀ ਜਿਹੀ ਕਲੀਅਰ ਆਵੇ ਨਾ ਕਿਹੜੀ ਐਂ ਵੀ ਚਾਰ ਪੰਜ ਜਣੇ ਇਕੱਠੇ ਖੜ੍ਹ ਕੇ ਖਿਚਵਾ ਲੈਂਦੇ ਫਿਰ ਉਹ ਕਈਆਂ ਦਾ ਕਵਰ ਨਹੀਂ ਹੁੰਦਾ ਨਾ

ਹਾਂਜੀ ਹਾਂਜੀ ਉਹਦੇ 'ਚ ਸਾਰੇ ਆ ਜਾਣਗੇ ਫਿਰ ਉਹ ਬਜਟ ਵੀ ਚੱਲੋ ਵਾਹਲੀ ਵੱਡੀ ਤਾਂ ਆਪਾਂ ਕੀ ਕਰਨੀ ਹੈ ਦਸ ਬਾਰਾਂ ਸਹੀ ਆ ਆਪਾਂ ਉਹ ਕਰਵਾ ਲਾਂਗੇ ਹਾਂਜੀ ਹਾਂਜੀ ਸਰ ਇਹ ਤੁਸੀਂ ਮਤਲਬ ਐਲਬਮ ਅ ਜਿਹੜੀ ਆਪਾਂ ਬਣਾਉਣੀ ਆ ਫੋਟੋਆਂ ਇੱਕ ਤਾਂ ਧੋ ਕੇ ਬਣਾਉਣੀ ਜੀ ਇੱਕ ਦੂਜੀ ਹੁੰਦੀ ਆ ਕਿਹੜੀ ਬਣਾਓਂਗੇ ਜੀ ਬੈਸਟ ਕਿਹੜੀ ਵਧੀਆ ਕਿਹੜੀ ਰਹੇਗੀ ਇੱਕ ਥ੍ਰੀ ਡੀ ਪੇਪਰ ਹੁੰਦਾ ਜੀ ਉਹ ਮੇਰੇ ਹਿਸਾਬ ਨਾਲ ਉਹ ਸਹੀ ਹੈ ਉਹ ਖਰਾਬ ਨਹੀ ਹੁੰਦਾ ਹਾਂਜੀ ਹਾਂਜੀ ਹਾਂਜੀ ਉਹ ਥ੍ਰੀ ਡੀ ਉਹ ਬਣਵਾਲਾਂਗੇ ਉਹ ਸਹੀ ਹੈ ਉਹ ਦੂਜੀਆਂ ਨਾ ਕਈ ਵਾਰ ਹੱਥ ਹੁੱਥ ਲਗਾਉਣੇ ਹੋਰ ਮੈਲੀ ਜਿਹੀ ਹੋ ਜਾਂਦੀ ਹੈ ਜਿਵੇਂ ਖਰਾਬ ਹੋ ਜਾਂਦੀਆਂ ਫੋਟੋਆਂ ਹਾਂ ਉਹ ਸਹੀ ਹੈ ਮੇਰੇ ਹਾਂਜੀ ਸਹੀ ਹੈ ਜੀ ਉਹ ਉਹ ਕਰਵਾ ਲਾਂਗੇ ਤਾਂ ਤੁਸੀਂ ਐਂ ਕਰਿਓ ਫਿਰ ਦਸ ਤਰੀਕ ਨੂੰ ਆਪਾਂ ਪ੍ਰੋਗਰਾਮ ਕਰਨਾ ਹੈਗਾ ਤੁਸੀਂ ਆ ਜਾਇਓ ਠੀਕ ਹੈ ਉੱਦੋਂ ਪਹਿਲਾਂ ਮਤਲਬ ਕੋਈ ਹੋਇਆ ਪ੍ਰੋਗਰਾਮ ਤਾਂ ਤੁਹਾਨੂੰ ਦੱਸ ਦਾਂਗੇ ਅਤੇ ਦਸ ਨੂੰ ਮੈਰਿਜ ਦਾ ਹੈਗਾ ਹੈ ਮੇਨ ਤਾਂ ਅਤੇ ਉੱਦੋਂ ਪਹਿਲਾਂ ਆਪਾਂ ਵੇਖ ਲਾਂਗੇ ਕੋਈ ਖਿਚਵਾਉਣੀ ਤਾਂ ਤੁਹਾਨੂੰ ਸੱਦ ਲਾਂਗੇ ਅਸੀਂ ਫੋ ਫੋਨ ਕਰਕੇ ਬੁਲਾ ਲਾਂਗੇ ਠੀਕ ਹੈ ਜੀ ਅਤੇ ਜਿਹੜਾ ਪ੍ਰੋਗਰਾਮ ਵੱਡਾ ਗਾ ਉਹ ਆਪਣਾ ਦਸ ਨੂੰ ਹੈਗਾ ਉਹ ਮੂਵੀ ਮੂਵੀ ਵਾਲਾ ਉਹ ਵੀ ਕਰਨਾ ਪ੍ਰੋਗਰਾਮ ਤਾਂ ਕਰਕੇ ਅਤੇ ਹਾਂਜੀ ਹਾਂਜੀ ਪ੍ਰੀਵੈਡਿੰਗ ਤੁਹਾਨੂੰ ਦੱਸਦਾਂਗੇ ਤਾਰੀਖ ਜਿੰਨੇ ਨੂੰ ਅਸੀਂ ਰੱਖਾਂਗੇ ਅਤੇ ਤੁਹਾਨੂੰ ਦੱਸ ਕੇ ਅਤੇ ਉਹ ਸੱਦ ਲਾਂਗੇ ਫੋਟੋਆਂ ਉਦੋਂ ਵੀ ਕਰਵਾਉਣੀਆਂ ਕਿਉਂਕਿ ਰਿਸ਼ਤੇਦਾਰ ਵੀ ਆਉਂਦੇ ਫਿਰ ਉਹ ਕਰਨਾ ਨਾ ਕੰਮ ਅਤੇ ਮੈਰਿਜ ਵਾਲਾ ਪ੍ਰੋਗਰਾਮ ਤਾਂ ਤੁਹਾਨੂੰ ਆਉਣਾ ਹੀ ਹੈ ਉਹ ਤੁਹਾਨੂੰ ਕਹਿ ਤਾ ਵੀ ਦਸ ਤਰੀਕ ਨੂੰ ਹੈਗਾ ਆਪਾਂ ਅਤੇ ਸਰ ਕੋਈ ਅਡਵਾਂਸ ਪੇਮੈਂਟ ਲੈਣੀ ਤੁਸੀਂ ਠੀਕ ਹੈ ਜੀ ਕਿੰਨੀ ਕੁ ਦੇਈਏ ਜੀ ਚੱਲੋ ਸਰ ਜੀ ਪੰਜ ਹਜ਼ਾਰ ਬਹੁਤ ਹੈ ਹਾਂਜੀ ਬਾਕੀ ਪੇਮੈਂਟ ਤੁਹਾਨੂੰ ਨਾ ਬਾਅਦ 'ਚ ਕਰਦਾਂਗੇ ਜਿਵੇਂ ਆਪਣੀਆਂ ਐਲਬਮ ਆ ਤਿਆਰ ਹੋਈ ਨਾ ਤੁਸੀਂ ਮੈਨੂੰ ਕੌਲ ਕਰਕੇ ਦੱਸ ਦਿਓ ਤਾਂ ਬਾਕ ਹਾਂਜੀ ਹਾਂਜੀ ਹਾਂਜੀ ਹਾਂ ਵੇਖ ਨਾ ਤੁਹਾਨੂੰ ਅਤੇ ਉੱਦੋਂ ਬਾਅਦ ਸਾਰੀ ਪੇਮੈਂਟ ਆਪਾਂ ਜਿਹੜੀ ਰਹਿੰਦੀ ਹੋਈ ਉਹ ਕਰਦਾਂਗੇ ਠੀਕ ਹੈ ਜੀ ਠੀਕ ਠੀਕ ਹਾਂ ਓਕੇ ਜੀ ਧੰਨਵਾਦ ਜੀ ਮੇਹਰਬਾਨੀ